ਹੈਲੋ ਪੀਜ਼ਾ ਪਲੈਨੇਟ ਹਾਂਜੀ ਮੈਂ ਤੁਹਾਨੂੰ ਆਪਣੀ ਕੁਛ ਹਦਾਇਤਾਂ ਦੇਣੀਆਂ ਸੀ ਜੋ ਮੈਂ ਤੁਹਾਡੇ ਰੈਸਟੋਰੈਂਟ ਵਿੱਚ ਕੁਛ ਵਧੀਆ ਨਹੀਂ ਲੱਗੀਆਂ ਸਭ ਤੋਂ ਪਹਿਲਾਂ ਗੱਲ ਇਹ ਵੀ ਤੁ ਤੁਹਾਡੀ ਜਿਹੜੀ ਕੁਰਸੀਆਂ ਸੀ ਸਾਰੀਆਂ ਗੰਦੀਆਂ ਸੀ ਜਿਹੜੀ ਪਲੇਟਸ ਵਿੱਚ ਖਾਣਾ ਸਰਵ ਹੋਇਆ ਉਹ ਵੀ ਬਹੁਤ ਅਜੀਬ ਜਿਹਾ ਦੇਖਣ ਨੂੰ ਲੱਗ ਰਿਹਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਫੂਡ ਵਿੱਚ ਜਿਹੜਾ ਸਵਾਦ ਸੀ ਉਹ ਵੀ ਕੁਛ ਵੀ ਨਹੀਂ ਕਿਸੇ ਮਾ ਨਮਕ ਘੱਟ ਸੀ ਕਿਸੇ ਮਾ ਕੁਛ ਸੀ ਸਾਰੀ ਉਹ ਚੀਜ਼ਾਂ ਮੰਨ ਲਓ ਦੂਸਰੀ ਗੱਲ ਇਹ ਉੱਥੇ ਰੈ ਜਿਹੜੀ ਸਾਫ ਸਫਾਈ ਬਿਲਕੁਲ ਬਿਲਕੁਲ ਨਹੀਂ ਸੀ ਅਤੇ ਸਾਰੇ ਉੱਪਰ ਕੰਧਾਂ ਉੱਪਰ ਜਾਲੇ ਜੁਲੇ ਲੱਗੇ ਹੋਏ ਸੀ ਤੁਸੀਂ ਇਸ ਚੀਜ਼ ਦੇ ਉੱਪਰ ਗੌਰ ਕਰੋ ਅਤੇ ਥੋੜ੍ਹਾ ਇਸਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ